ਸਤਿ ਸ਼੍ਰੀ ਅਕਾਲ ਜੀ ਕੀ ਮੇਰੀ ਗੱਲ ਸਵਿਗੀ ਹੈਲਪਲਾਈਨ ਨਾਲ ਹੋ ਰਹੀ ਹੈ ਮੈਂ ਰਵੀ ਗਿਰੀ ਗੱਲ ਕਰ ਰਿਹਾ ਹਾਂ ਹਾਲ ਹੀ ਵਿੱਚ ਮੈਂ ਆਪਣਾ ਫੋਨ ਚੇਂਜ ਕੀਤਾ ਹੈ ਅਤੇ ਜਿਸ ਕਾਰਨ ਮੇਰੇ ਜਿੰਨੇ ਵੀ ਪੁਰਾਣੇ ਬਿੱਲ ਕੋਡ ਸੀ ਉਹ ਮੇਰੇ ਫੋਨ ਚੋਂ ਡਿਲੀਟ ਹੋ ਚੁੱਕੇ ਨੇ ਅਤੇ ਕੀ ਤੁਸੀਂ ਮੇਰੀ ਉਹ ਰਿਕੋਡ ਦੁਬਾਰਾ ਲਿਆਉਣ 'ਚ ਹੈਲਪ ਕਰ ਸਕਦੇ ਹੋ ਅਤੇ ਮੈਂ ਨਾ ਕਾਫੀ ਟਾਈਮ ਪਹਿਲਾਂ ਜਿਵੇਂ ਸਵਿਗੀ ਤੋਂ ਆਪਣੇ ਲਾਗੇ ਨੇੜਿਆਂ ਦੇ ਢਾਬਿਆਂ ਤੋਂ ਰੈਸਟੋਰੈਂਟਾਂ ਤੋਂ ਆਰਡਰ ਵਗੈਰਾ ਕਰਦਾ ਸੀ ਅਤੇ ਉਹਨਾਂ ਸਾਰਿਆਂ ਦੇ ਮੇਰੇ ਕੋਲ ਬਿੱਲ ਮੌਜੂਦ ਸੀਗੇ ਬਟ ਫੋਨ ਮੇਰਾ ਚੇਂਜ ਹੋਣ ਕਾਰਨ ਉਹ ਮੇਰੇ ਕੋਲ ਜਿੰਨੇ ਵੀ ਰਿਕੋਡ ਸੀਗੇ ਉਹ ਸਾਰੇ ਮੇਰੇ ਤੋਂ ਰੱਦ ਹੋ ਗਏ ਅਤੇ ਮੈਂ ਚਾਹੁੰਦਾ ਕਿ ਉਹ ਮੇਰੇ ਜਿੰਨੇ ਵੀ ਰਿਕੋਡ ਨੇ ਉਹ ਮੈਨੂੰ ਦੁਬਾਰਾ ਮੇਰੇ ਉਵੇਂ ਹੀ ਮਿਲ ਜਾਣ ਅਤੇ ਮੈਨੂੰ ਇਸ ਕਰਕੇ ਤੁਸੀਂ ਜਾਂ ਤਾਂ ਮੈਨੂੰ ਫੋਨ 'ਤੇ ਗਾਈਡ ਕਰ ਦਿਉ ਜਾਂ ਕੋਈ ਮੈਸੇਜ ਦੇ ਥਰੂ ਲਿੰਕ ਭੇਜ ਕੇ ਆਪਣਾ ਲਿੰਕ ਭੇਜ ਦਿਓ ਤਾਂ ਕਿ ਜੋ ਮੈਂ ਸਿੱਧਾ ਹੀ ਆਪਣੇ ਉੱਥੋਂ ਬਿੱਲ ਡਾਊਨਲੋਡ ਕਰ ਸਕਾਂ ਧੰਨਵਾਦ